ਹੈਲੋ ਹਾਂਜੀ ਟਰੈਵਲਸ ਬੋਲ ਰਹੇ ਹੋ ਹਾਂ ਸਰ ਆਪਾਂ ਕੇਰਲਾ ਤੋਂ ਆ ਰਹੇ ਹੈ ਬਠਿੰਡਾ ਮੇਂ ਤਿੰਨ ਦਿਨ ਰਹਿਣਾ ਹੈ ਅਤੇ ਤਿੰਨ ਦਿਨ ਵਿੱਚ ਤੁਸੀਂ ਕਿੱਥੇ ਲੈ ਜਾ ਸਕਦੇ ਸਾਨੂੰ ਅਸੀਂ ਇੱਥੇ ਉੱਨੀ ਜੂਨ ਨੂੰ ਹਾਂਂਜੀ ਮੋਰਨਿੰਗ ਮੋਰਨਿੰਗ ਸੁਬਾਹ ਹਾਂਜੀ ਹਾਂਜੀ ਅੱਛਾ ਜੀ

ਅੱਛਾ ਜੀ

ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹੋਰ ਜੀ

ਤੁਸੀਂ ਇੱਥੇ ਸਪੋਰਟਸ ਬਾਰੇ ਹੈ ਜਿਹੜਾ ਸਪੋਟਸ ਸਪੋਰਟਸ ਬਾਰੇ ਚੀਜ਼ਾਂ ਹੈ ਵੇਖਣ ਯੋਗ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਫਿਰ ਕਿੰਨੇ ਦਿਨਾਂ ਦੇ ਕਿੰਨੇ ਪਏ ਫਿਰ ਤਾਂ ਅੱਛਾ ਜੀ ਚਲੋ ਚਲੋ ਠੀਕ ਹੈ ਜੀ ਹਾਂਜੀ